ਭਾਰਤ ਵਿੱਚ ਬਹੁਤ ਤਰ੍ਹਾਂ ਦੇ ਨਾਚ ਹਨ ਪਰ ਪ੍ਰਸਿੱਧ ਨਾਚ ਜਿਵੇਂ ਪੰਜਾਬ ਵਿੱਚ ਭੰਗੜਾ ਅਤੇ ਗਿੱਧਾ ਜਿਵੇਂ ਭੰਗੜੇ ਅਤੇ ਗਿੱਧੇ ਦੇ ਵੀ ਕਈ ਪ੍ਰਕਾਰ ਪ੍ਰਕਾਰ ਹਨ ਜਿਵੇਂ ਮਲਵਈ ਗਿੱਧਾ ਮਜੈਬ ਗਿੱਧਾ ਪੁਆਧ ਗਿੱਧਾ ਅਲੱਗ ਅਲੱਗ ਤਰ੍ਹਾਂ ਦੇ ਗਿੱਧੇ ਹੁੰਦੇ ਹਨ ਜਿਵੇਂ ਭੰਗੜੇ ਵਿੱਚ ਝੂੰਮਰ ਜੁੱਤੀ ਫ਼ਸਲਾਂ ਅਲੱਗ ਅਲੱਗ ਪ੍ਰਕਾਰ ਦੀਆਂ ਚੀਜ਼ਾਂ ਹੁੰਦੀਆਂ ਹਨ ਪੰਜਾਬ ਦੀ ਇੱਕ ਬਹੁਤ ਮਸ਼ਹੂਰ ਡਾਂਸਰ ਹੈ ਜਿਹਦਾਂ ਨਾਂ ਹੈ ਮਨਪ੍ਰੀਤ ਤੂਰ ਮੈਂ ਉਹਨਾਂ ਨੂੰ ਦੇਖ ਦੇਖ ਕੇ ਹੀ ਡਾਂਸ ਸਿੱਖਦੀ ਹਾਂ ਅਤੇ ਉਵੇਂ ਹੀ ਕਰਦੀ ਹਾਂ ਉਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ ਅਤੇ ਮੈਂ ਉਹਨਾਂ ਨੂੰ ਹੀ ਦੇਖ ਕੇ ਡਾਂਸ ਕਰਨਾ ਸ਼ੁਰੂ ਕੀਤਾ ਸੀ